ਹਾਂਜੀ ਜੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਕਿਹੜੇ ਐਕਟਰ ਹੈ ਜਿਹੜੇ ਬੋਲੀਵੁੱਡ ਵਿੱਚ ਕੰਮ ਕਰਦੇ ਆ ਹਾਂਜੀ

ਠੀਕ ਹੈ ਜੀ ਠੀਕ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਜੀ ਓਕੇ ਜੀ